ਪੰਜਾਬ ਦਾ ਪੰਜਾਬ ਦੇ ਵਿੱਚ ਜਿਹੜਾ ਵਪਾਰਕ ਖੇਤਰ ਹੈ ਉਹ ਨਵੀਨਤਾ ਜਾਂ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਦਾ ਹੈ ਬਹੁਤ ਜਿਆਦਾ ਉਤਸ਼ਾਹਿਤ ਕਰਦਾ ਹੈ ਬਹੁਤ ਜਿਆਦਾ ਸਮਰਥਨ ਕਰਦਾ ਹੈ ਕਿਉਂਕਿ ਇੱਥੇ ਹੋਣ ਵਾਲੀ ਜਿਹੜੀ ਖੋਜ ਹੈ ਉਹ ਐਨਕਰੇਜ ਕਰਦੀ ਹੈ ਲੋਕਾਂ ਨੂੰ ਇੱਥੇ ਜਿਹੜਾ ਆ ਵਪਾਰਕ ਖੇਤਰ ਦੇ ਵਿੱਚ ਆਪਣੀ ਜਾਨ ਦੇ ਲਈ ਇੱਥੇ ਦੀ ਲੋਕਾਂ ਦੀ ਜਿਹੜੀ ਆ ਬੌਧਿਕ ਜਾਇਦਾਤ ਵੀ ਹੈ ਜਿਹੜੀ ਕੀ ਜਿਸ ਨੂੰ ਲੈ ਕੇ ਲੋਕੀ ਆਪਣਾ ਜਿਹੜਾ ਆ ਬਿਜਨਸ ਹੈ ਵਪਾਰ ਹੈ ਉਸ ਨੂੰ ਚੰਗੀ ਤਰੀਕੇ ਨਾਲ ਸੈਟ ਕਰ ਸਕਦੇ ਹਨ